ਮੋਹਾਲੀ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦਨ ਬਹੁਤ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਝੋਨਾ ਕਣਕ ਮੱਕੀ ਆਦਿ ਇਹ ਸਿੰਚਾਈ ਦੇ ਸਾਧਨ ਵੀ ਹਨ ਜਿਵੇਂ ਕਿ ਪਸ਼ੂ ਪਸ਼ੂ ਬਲਦ ਆਦਿ ਇਹ ਪਹਿਲਾਂ ਬ ਬਲਦਾਂ ਦੇ ਰਾਹੀਂ ਕੀਤਾ ਜਾਂਦਾ ਸੀਗਾ ਅਤੇ ਹੁਣ ਟੈਕਨੋਲਜੀ ਆ ਗਈ ਹੈ ਇਹ ਟਰੈਕਟਰਾਂ ਅਤੇ ਮੋਟਰਾਂ ਦੇ ਤਰ੍ਹਾਂ ਕੀਤਾ ਜਾਂਦਾ ਹੈ